ਡਿਜੀਟਲ ਕਲਾ ਨੇ ਮਨੁੱਖ ਦੀ ਜ਼ਿੰਦਗੀ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ ਹੈ ਡਿਜੀਟਲ ਕਲਾ ਦੇ ਨਾਲ ਜੇ ਕਹੀਏ ਤਾਂ ਇੱਕ ਡਿਜੀਟਲ ਯੁੱਗ ਦੀ ਸ਼ੁਰੂਆਤ ਹੋਈ ਹੈ ਜਿਸ ਨੂੰ ਕਿ ਕੰਪਿਊਟਰ ਯੁੱਗ ਕਿਹਾ ਜਾਂਦਾ ਆ ਦੇਖਣ ਦੇ ਵਿੱਚ ਆਇਆ ਵੀ ਜਿੱਥੇ ਪਹਿਲਾਂ ਐਨਾਲੋਗ ਟੈਕਨੋਲੋਜੀ ਕੰਮ ਕਰਦੀ ਸੀਗੀ ਉਸ ਉੱਥੇ ਹੀ ਡਿਜਟਲ ਟੈਕਨੋਲੋਜੀ ਦੇ ਨਾਲ ਆਉਣ ਨਾਲ ਬਹੁਤ ਸਾਰੇ ਜਿਹੜੀਆਂ ਅ ਅਵਿਸ਼ਕਾਰ ਹੋ ਸਕੇ ਹੈ ਜਿਸਨੇ ਕਿ ਮਨੁੱਖ ਦੀ ਜ਼ਿੰਦਗੀ ਨੂੰ ਬਹੁਤ ਪ੍ਰਭਾਵਿਤ ਕੀਤਾ ਆ ਡਿਜੀਟਲ ਕਲਾ ਨੇ ਜਿੱਥੇ ਮਨੁੱਖ ਨੂੰ ਨਵੇਂ ਅਨੁਭਵ ਦਿੱਤੇ ਹੈ ਟੈਕਨੋਲਜੀ ਦਿੱਤੀ ਹੈ ਔਰ ਮਨੁੱਖ ਦੀ ਜ਼ਿੰਦਗੀ ਸੁਖਾਲੀ ਅਤੇ ਖੂਬਸੂਰਤ ਬਣਾਈ ਹੈ ਅਤੇ ਇਸ ਕਰਕੇ ਜਿਹੜੀ ਡਿਜੀਟਲ ਕਲਾ ਹੈ ਉਸਨੇ ਮਨੁੱਖ ਦੀ ਜ਼ਿੰਦਗੀ ਨੂੰ ਜਿੱਥੇ ਪ੍ਰਭਾਵਿਤ ਕੀਤਾ ਹੈ ਉੱਥੇ ਸੁਖਾਲਾ ਵੀ ਕੀਤਾ ਹੈ ਡਿਜੀਟਲ ਕਲਾ ਜੇ ਕਹੀਏ ਤਾਂ ਮਨੁੱਖ ਦੇ ਦੁਆਰਾ ਹੀ ਕਾਲਪਿਤ ਕੀਤੀ ਗਈ ਹੀ ਇੱਕ ਇਹ ਇਹੀ ਜਿਹੀ ਕਲਾ ਹੈ ਜਿਸਨੇ ਕਿ ਮਨੁੱਖ ਦੀ ਅ ਜ਼ਿੰਦਗੀ ਦੇ ਨਾਲ ਨਾਲ ਬਾਕੀ ਜੀਵਾਂ ਦੀ ਜ਼ਿੰਦਗੀ ਨੂੰ ਵੀ ਪ੍ਰਭਾਵਿਤ ਕੀਤਾ ਹੈ ਡਿਜੀਟਲ ਕ ਦੇ ਨਾਲ ਹੀ ਅੱਜ ਜੇ ਸੰਭਵ ਹੋ ਪਾਇਆ ਮਨੁੱਖ ਇੱਥੇ ਬੈਠਾ ਦੁਨੀਆਂ ਦੇ ਕਿਸੇ ਖਿੱਤੇ ਦੇ ਵਿੱਚ ਬੈਠੇ ਹੋਏ ਮਨੁੱਖ ਨਾਲ ਜਿਹੜਾ ਉਹ ਤਾਲਮੇਲ ਕਰ ਸਕਦਾ ਹੈ ਡਿਜੀਟਲ ਯੁੱਗ ਦੀ ਜੇ ਆਪਾਂ ਗੱਲ ਕਰੀਏ ਤਾਂ ਮਨੁੱਖ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਅਤੇ ਮਨੁੱਖ ਦੇ ਲਈ ਬਹੁਤ ਸਾਰੇ ਸੁਖਾਲੇ ਅਤੇ ਸੁੱਖ ਅਤੇ ਜਿਹੜੇ ਪ੍ਰਬੰਧ ਉਹ ਕੀਤੇ ਆ ਉਹ ਡਿਜੀਟਲ ਕਲਾ ਰਾਹੀਂ ਹੀ ਮਨੁੱਖ ਦੀ ਆਪਣੀ ਸਾਜੀ ਹੋਈ ਕਲਾ ਰਾਹੀਂ ਹੀ ਸੰਭਵ ਹੋ ਪਾਇਆ ਹੈ